ਹੈਲੋ ਹਾਂਜੀ ਸਰ ਹਾਂਜੀ ਮੈਂ ਪੁੱਛ ਰਹੀ ਸੀ ਵੀਰੇ ਆਪਣੇ ਇਥੇ ਤੁਸੀਂ ਫਾਰਮਰ ਹੋਨਾ ਤੇ ਹਾਂਜੀ ਸਰ ਇੱਥੇ ਆਉਣਾ ਵੀ ਆਪਣੇ ਕਣਕ ਦਾ ਕਿਵੇਂ ਬੀ ਉਹਨੇ ਤੇ ਕਿਸ ਚੀਜ਼ ਦਾ ਸੀਜ਼ਨ ਚੱਲ ਰਿਹਾ ਅੱਛਾ ਚਾਵਲ ਕਿਹੜੇ ਕਿਹੜੇ ਬਾਸਮਤੀ ਜਾਂ ਕੋਈ ਅੱਛਾ ਜੀ ਅੱਛਾ ਮਤਲਬ ਦੀ ਹਾਲੇ ਵੀ ਬੀਜਿਆ ਕਿਵੇਂ ਕਟਾਈ ਹੋ ਗਈ ਉਹਨਾਂ ਦੀ

ਅੱਛਾ ਹਾਂਜੀ ਹਾਂਜੀ ਹਾਂਜੀ ਚਾਤੇ ਆ ਇਸ ਤੋਂ ਬਾਅਦ ਹਾਂਜੀ ਕੀ ਬੀਜੋਗੇ ਫਿਰ ਪਛਤਾ ਹੋ ਗਿਆ ਨਾ ਜਿਵੇਂ ਹੁਣ ਤਾਂ ਇੱਕ ਕਦਮ ਤਾਂ ਵੀ ਇਸ ਤੋਂ ਬਾਅਦ ਤਾਈਆਂ ਦੇ ਕੱਟਣ ਤੋਂ ਬਾਅਦ ਹੋਰ ਕੀ ਬੀਜਦੇ ਹੋ ਅੱਛਾ ਜੀ ਪਸ਼ੂਆਂ ਵਾਸਤੇ

ਹਾਂਜੀ ਹਾਂਜੀ ਸਾਰਾ ਮਤਲਬ ਤੁਸੀਂ ਵੀ ਆਪਣੇ ਵੱਠੇ ਬੀਦੇ ਖੇਤ ਵਿੱਚ ਵੀ ਤੁਸੀਂ ਕੋਈ ਹੋਰ ਸਬਜ਼ੀ ਵਗੈਰਾ ਕੀ ਕੀ ਬੀਜਦੇ ਹੋ ਅੱਛਾ ਠੀਕ ਨਵੇਂ ਰੁੱਤ ਦੇ ਹਿਸਾਬ ਨਾਲ ਬੀਚ ਦਿਓ ਹਾਂਜੀ ਤੇ ਉਹ ਹੁਣ ਤੇ ਥੋੜਾ ਠੰਡਾ ਮੀਠਾ ਜਿਹਾ ਮੌਸਮ ਸ਼ੁਰੂ ਹੋ ਗਿਆ ਮਤਲਬ ਕਿਤੇ ਸਰਦੀਆਂ ਦੇ ਮੌਸਮ ਤੇ ਇਹਦੇ ਚ ਵੀ ਹੋਰ ਕੀ ਕੀ ਬੀਜੋਗੇ ਤੁਸੀਂ ਮੈਂ ਅੱਛਾ ਜੀ ਤੇ ਗੰਨੇ ਦਾ ਸੀਜਨ ਮਤਲਬ ਕੀ ਉਸ ਤੋਂ ਬਾਅਦ ਜਿਵੇਂ ਹੁਣ ਕਣਕ ਦਾ ਸੀਜ਼ਨ ਹੋ ਗਿਆ ਫਿਰ ਉਸ ਤੋਂ ਬਾਅਦ ਪਹਿਲਾਂ ਉਸਤੋਂ ਅੱਛਾ ਤੂੰ ਦੇਖਿ ਚਲ ਗੀ ਭਾਵੇਂ ਚ ਪੱਠੇ ਬੀਜ ਲਓ ਭਾਵੇਂ ਚਾਦਰ ਨੀ ਬੀਜ ਲ ਵੀ ਇਨੇ ਹਾਂਜੀ ਹਾਂਜੀ

ਤੇ ਹੋਰ ਵੀ ਖੇਤਾਂ ਦੇ ਮਾਮਲੇ ਵਿੱਚ ਮਲਕੀਤ ਸੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਰਦੇ ਹੋ ਹੁਣ ਸਬਜੀਆਂ ਲਿਖ ਦੇ ਰਿਹਾ ਹਾਂਜੀ ਅੱਛਾ ਜੀ ਹਾਂਜੀ ਟਾਈਮ ਮੈਂ ਪੁੱਛਿਆ ਹਰਵੀਰ ਸਰ ਵੀ ਆਪਣੇ ਜਿਵੇਂ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਧਾਈਆਂ ਦਾ ਸੀਜ਼ਨ ਚੱਲ ਰਿਹਾ ਉਸ ਤੋਂ ਬਾਅਦ ਤੁਸੀਂ ਪੱਟੇ ਆ ਮਤਲਬ ਕੀ ਗੰਨੇ ਦਾ ਸੀਜਨ ਡਰ ਜਾਏਗਾ ਵੀ ਆਹ ਦੋਨਾਂ ਚ ਹਾਂਜੀ ਗਰਮੀਆਂ ਦੇ ਵਿੱਚ ਨਲਕ ਵੀ ਤੁਸੀਂ ਕੀ ਕੀ ਬੀਜਦੇ ਹੋ ਹਾਂਜੀ ਠੀਕ ਹ ਗਰਮੀਆਂ ਦੀ ਸਬਜ਼ੀ ਬਾਰੇ ਕੁਝ ਨੋਲੇਜ ਤੁਸੀਂ ਦੱਸੋ ਵੀ ਤੁਹਾਨੂੰ ਕੀ ਕੀ ਨੋਲੇਜ ਹ ਸਰ ਹਾਂਜੀ ਜਿਵੇਂ ਵੀ ਆਪਣੇ ਝੰਡੀ ਸਬਜ਼ੀਆਂ ਜਿਵੇਂ ਹੋਈਆਂ ਜਿਵੇਂ ਕੋਈ ਢਿੰਦੇ ਆ ਪਿਆਜ ਆ ਮੇਰਾ ਵੀ ਇਹ ਤੁਸੀਂ ਗਰਮੀਆਂ ਚ ਵੀਰਦੇ ਹੋ ਕਿ ਸਾਡੀਆਂ ਚ ਵੀ ਸਰ ਜੀ ਚ ਗਰਮੀਆਂ ਚ ਵੀ ਜਿਤੇ ਹਾਜੀ ਇਹ ਸਾਰੀ ਗਰਮੀ ਜੀ ਓਕੇ ਹਾਂਜੀ ਠੀਕ ਏ ਸਰ ਠੀਕ